ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦੱਸੋ ਹਾਂਜੀ ਮੈਂ ਤੁਹਾਡੇ ਕੋਲੋਂ ਦੁੱਧ ਲੈ ਕੇ ਗਈ ਸੀ ਦੁੱਧ ਤੁਹਾਡਾ ਖ਼ਰਾਬ ਨਿਕਲਿਆ ਹਾਂਜੀ ਦੁੱਧ ਦੁੱਧ ਤੁਹਾਡਾ ਸੀ ਗਰਮ ਕੀਤਾ ਉਹਦੇ 'ਤੇ ਮਲਾਈ ਭੋਰਾ ਵੀ ਨਹੀਂ ਆਈ ਨਹੀਂ ਨਹੀਂ ਜੀ ਬਰਤਨ ਬਿਲਕੁਲ ਸਾਫ਼ ਕਰਕੇ ਫਿਰ ਹੀ ਦੁੱਧ ਗਰਮ ਕਰੀ ਦਾ ਇੱਕ ਤਾਂ ਉੱਤੇ ਮਲਾਈ ਨਹੀਂ ਬੱਝੀ ਇੱਕ ਬਾਕੀ ਬੱਚਿਆਂ ਨੂੰ ਪਿਆਇਆ ਬੱਚਿਆਂ ਦੇ ਪੇਟ ਖ਼ਰਾਬ ਹੋ ਗਿਆ ਉਹਦੇ ਨਾਲ ਪਤਾ ਨਹੀਂ ਸਾਡੇ ਕੋਲ ਤਾਂ ਖ਼ਰਾਬੀ ਨਿਕਲੀ ਆ ਜੀ ਅਸੀਂ ਹੁਣ ਤਾਂ ਹੀ ਤੁਹਾਨੂੰ ਉਲਾਂਭਾ ਦਿੱਤਾ ਹੈ ਨਾ ਵੀ ਦੁੱਧ ਖ਼ਰਾਬ ਕਰਕੇ ਮਿਲਾਵਟ ਆ ਵੈਸੇ ਵੀ ਮਿਲਾਵਟ ਆ ਗਾਈਆਂ ਗਾਵਾਂ ਦਾ ਅਤੇ ਮੱਝਾਂ ਦਾ ਦੁੱਧ ਮਿਲਾ ਕੇ ਤੁਸੀਂ ਸਾਨੂੰ ਦੇ ਰਹੇ ਹੋ ਨਹੀਂ ਨਹੀਂ ਜੀ ਪਤਾ ਜੀ ਡਾਇਰੀਆਂ ਵਾਲੇ ਪਤਾ ਕੀ ਕਰਦੇ ਨੇ ਦੁੱਧ 'ਚ ਖ਼ਰਾਬੀ ਕਰ ਦਿੰਦੇ ਨੇ ਕੈਮੀਕਲ ਮਿਲਾ ਦਿੰਦੇ ਨੇ ਅਤੇ ਉਹਦੇ ਨਾਲ ਬੱਚਿਆਂ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ ਸਾਡਾ ਇੱਕ ਬੱਚਾ ਬਿਮਾਰ ਆ ਅਸੀਂ ਡਾਕਟਰ ਕੋਲ ਗਏ ਉਹਨੇ ਸਾਨੂੰ ਇਹ ਹੀ ਸਲਾਹ ਦਿੱਤੀ ਵੀ ਤੁਹਾਡੇ ਬੱਚੇ ਨੇ ਕੋਈ ਇਹੋ ਜਿਹੀ ਗਲਤ ਚੀਜ਼ ਪੀਤੀ ਹੈ ਜਿਹਦੇ ਨਾਲ ਬੱਚਾ ਬਿਮਾਰ ਹੋ ਗਿਆ ਅਤੇ ਅਸੀਂ ਉਸ ਨੂੰ ਦੁੱਧ ਹੀ ਦਿੱਤਾ ਸੀ ਹੋਰ ਉਹਨੂੰ ਕੁਛ ਨਹੀਂ ਖਵਾਇਆ ਨਹੀਂ ਨਹੀਂ ਜੀ ਬੱਚਾ ਦੁੱਧ ਪੀਣ ਨਾਲ ਹੀ ਬਿਮਾਰ ਹੋਇਆ

ਹਾਂਜੀ ਪਰ ਬੱਚਾ ਦੁੱਧ ਤਾਕਤ ਵਾਲਾ ਹੈ ਹੀ ਨਹੀਂ ਸੀ ਦੁੱਧ ਬਿਲਕੁਲ ਸਪਰੇਟਾ ਸੀ ਜੀ ਉਹ ਤਾਂ ਠੀਕ ਹੈ ਜੀ ਫਿਰ ਸਾਡੇ ਦ ਸਮਝਣ ਦੇ ਵਿੱਚ ਹੀ ਗਲਤੀ ਹੋ ਗਈ ਹੋਵੇਗੀ ਠੀਕ ਹੈ ਜੀ ਧੰਨਵਾਦ ਜੀ